ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਸਰ ਤਰਨ ਭਾਅ ਜੀ ਬੋਲਦੇ ਪਏ ਟਰਾਂਸਪੋਰਟੇਸ਼ਨ ਔਫ ਮੋਡਸ ਤੋਂ ਠੀਕ ਹੈ ਭਾਅ ਜੀ ਮੈਂ ਇੰਗਲੈਂਡ ਤੋਂ ਨਾ ਐਕਚੁਲੀ ਅੰਮ੍ਰਿਤਸਰ ਆਉਣਾ ਸੀ ਮੇਰਾ ਨਾਮ ਪ੍ਰਿਤਪਾਲ ਸਿੰਘ ਹੈਗਾ ਅਤੇ ਮੈਂ ਤੁਹਾਡੇ ਕੋਲ ਕੋਈ ਸਜੈਸ਼ਨ ਲੈਣੀ ਸੀ ਕਿ ਇੱਥੋਂ ਆਉਣ ਦੇ ਕੀ ਕੀ ਮੋਡਸ ਹੈਗੇ ਨੇ ਮਤਲਬ ਮੈਂ ਕਿੱਦਾਂ ਆ ਸਕਦਾ ਇੱਥੇ ਹਾਂਜੀ

ਠੀਕ ਆ ਠੀਕ ਆ ਸਿੱਧੀ ਹਾਂਜੀ ਠੀਕ ਹੈ ਠੀਕ ਹੈ ਮਤਲਬ ਨਾ ਮੈਨੂੰ ਇੱਦਾਂ ਕੋਈ ਨਹੀਂ ਹੈਗਾ ਕਿ ਮਤਲਬ ਐਕਸਪੈਂਸਿਵ ਪਵੇ ਜਾਂ ਘੱਟ ਪਵੇ ਮਤਲਬ ਨਾ ਸਾਰੇ ਮਤਲਬ ਜਿੰਨੇ ਵੀ ਅੰਮ੍ਰਿਤਸਰ 'ਚ ਮਤਲਬ ਜਿੱਦਾਂ ਹੈਗੇ ਆ ਦਰਬਾਰ ਸਾਹਿਬ ਹੋ ਗਿਆ ਜਾਂ ਰਾਮ ਤੀਰਥ ਦਾ ਮੰਦਰ ਹੋ ਗਿਆ ਉੱਥੇ ਹੈਗਾ ਨਾ ਜਾਂ ਕੋਈ ਵੀ ਮਿਊਜ਼ੀਅਮ ਵਗੈਰਾ ਹੋ ਗਿਆ ਕੋਈ ਤੀਰਥ ਸਥਾਨ ਹੋ ਗਿਆ ਜਾਂ ਕੋਈ ਘੁੰਮਣ ਵਾਲੀ ਜਗ੍ਹਾ ਹੋ ਗਈ ਮਤਲਬ ਇੱਥੇ ਆਪਾਂ ਘੁੰਮਣਾ ਹੋਵੇ ਤਾਂ ਆਪਾਂ ਕਿਸ ਦੇ ਥਰੂ ਘੁੰਮ ਸਕਦੇ ਹਾਂ ਬੱਸ ਬੈਟਰ ਰਹੇਗੀ ਕਿ ਸਾਨੂੰ ਕੋਈ ਟ੍ਰੇਨ ਜਾਂ ਕੁਛ ਕੈਬ ਕੂਬ ਵਗੈਰਾ ਬੁੱਕ ਕਰਨੀ ਪਵੇਗੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਆ ਥੈਂਕ ਯੂ ਭਾਅ ਜੀ ਥੈਂਕ ਯੂ ਸੋ ਮੱਚ